ਹਾਂਜੀ ਕਾਰੋਬਾਰ ਸ਼ੁਰੂ ਕਰਨ ਵਿੱਚ ਪੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੱਚਾ ਮਾਲ ਦੀ ਪ੍ਰੋਬਲਮ ਆਉਂਦੀ ਹੈ ਸੈਕਿੰਡ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਲੇਬਰ ਦੀ ਥਰਡ ਪ੍ਰੋਬਲਮ ਆਉਂਦੀ ਫਾਈਨੈਂਸ ਦੀ ਇਹਨਾਂ ਸਾਰੇ ਪ੍ਰੋਬਲ ਇਹਨਾਂ ਸਾਰੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਕਰਕੇ ਨਾ ਪੇਂਡੂ ਖੇਤਰ ਵਿੱਚ ਕੋਈ ਵੀ ਜਿਹੜਾ ਇਹ ਕਾਰੋਬਾਰ ਸ਼ੁਰੂ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਭਾਰਤ ਵਿੱਚ ਇਹਨਾਂ ਚੀਜ਼ਾਂ ਪੇਂਡੂ ਕਾਰੋਬਾਰ ਨੂੰ ਵਧਾਵਾ ਦੇਣ ਲਈ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾ ਪੈਣਾ ਕਿ ਉਹਨਾਂ ਨੂੰ ਕੱਚਾ ਮਾਲ ਆਸਾਨੀ ਨਾਲ ਅਵੇਲੇਬਲ ਹੋਵੇ ਦੂਸਰਾ ਉਹਨਾਂ ਨੂੰ ਜਿਹੜਾ ਫਾਇਨਾਂਸ ਹੈ ਇਸ ਤਰ੍ਹਾਂ ਦੇ ਬੈਂਕ ਲੋਨਸ ਵਗੈਰਾ ਉਹਨਾਂ ਨੂੰ ਆਸਾਨੀ ਨਾਲ ਮਿਲ ਜਾਣੇ ਚਾਹੀਦੇ ਨੇ ਦੂਜਾ ਜਿਹੜੀ ਲੇਬਰ ਹੈ ਉਹ ਆਸਾਨੀ ਨਾਲ ਅਵੇਲੇਬਲ ਹੋ ਜਾਵੇ ਅਤੇ ਤਾਂ ਹੀ ਇਹ ਜਿਹੜਾ ਪੇਂਡੂ ਖੇਤਰ ਵਿੱਚ ਕਾਰੋਬਾਰ ਜਿਹੜਾ ਹੈ ਉਹ ਹੋ ਸਕਦਾ ਹੈ ਦੂਜਾ ਨਵੀਨੀਕਰਨ ਕਿ ਕ ਮ ਪੇਂਡੂ ਲੋਕਾਂ ਨੂੰ ਹਰ ਚੀਜ਼ ਬਾਰੇ ਜਾਣਕਾਰੀ ਮਿਲੇ ਕਿ ਅੱਜ ਕੱਲ੍ਹ ਜਿਹੜਾ ਅੱਜ ਕੱਲ੍ਹ ਦੇ ਆਧੁਨਿਕ ਯੁੱਗ ਵਿੱਚ ਕੀ ਨਵਾਂ ਚੱਲ ਰਿਹਾ ਉਹਨਾਂ ਨਵੀਆਂ ਤਕਨੀਕਾਂ ਨਵੀਆਂ ਨਵੇਂ ਔਜ਼ਾਰਾਂ ਨਵੀਆਂ ਕਈ ਚੀਜ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਨਾਲ ਕਿ ਉਹ ਆਪਣਾ ਜਿਹੜਾ ਪੇਂਡੂ ਖੇਤਰ ਵਿੱਚ ਕੋਈ ਵੀ ਸਮਾਲ ਸਕੇਲ ਇੰਡਸਟਰੀ ਉਹ ਸ਼ੁਰੂ ਕਰ ਸਕਣ ਅਤੇ ਉਹਨਾਂ ਨੂੰ ਉਹਦੇ ਬਾਰੇ ਨੌਲੇਜ ਦੇਣ ਲਈ ਸਰਕਾਰ ਨੂੰ ਇਹੋ ਜਿਹੀ ਪ੍ਰੋਵੀਜ਼ਨ ਕਰਨੀ ਚਾਹੀਦੀ ਹੈ ਇਹੋ ਜਿਹਾ ਕੋਈ ਤਰੀਕਾ ਅਪਣਾਉਣਾ ਚਾਹੀਦਾ ਜਿਸ ਨਾਲ ਕਿ ਉਹਨਾਂ ਨੂੰ ਕੋਈ ਨਾ ਕੋਈ ਕਾਰੋਬਾਰ ਦੀ ਇਹ ਆਧੁਨਿਕ ਜਾਣਕਾਰੀ ਦਿੱਤੀ ਜਾਵੇ ਜਿਸ ਨਾਲ ਕਿ ਪੇਂਡੂ ਖੇਤਰ ਵਿੱਚ ਲੋਕ ਆਪਣਾ ਕੋਈ ਸਮਾਲ ਸਕੇਲ ਇੰਡਸਟਰੀ ਜਾਂ ਸਮਾਲ ਸਕੇਲ ਕੋਈ ਵੀ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਉਹਨਾਂ ਨੂੰ ਇਹ ਮਤਲਬ ਲੋਨ ਜਾਂ ਬੈਂਕ ਕੋਈ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੋਣੀ ਚਾਹੀਦੀ ਜਿਸ ਨਾਲ ਕਿ ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਆਸਾਨੀ ਨਾਲ ਅਵੇਲੇਬਲ ਹੋ ਜਾਣ ਅਤੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਕਿੱਤਾ ਸ਼ੁਰੂ ਕਰਨਾ ਹੈ ਪੇਂਡੂ ਖੇਤਰ ਵਿੱਚ ਜਿਹੜਾ ਕੋਈ ਆਪਣਾ ਕਿੱਤਾ ਸ਼ੁਰੂ ਕਰਨਾ ਅਤੇ ਉਹਦੇ ਬਾਰੇ ਉਹਨਾਂ ਨੂੰ ਆਧੁਨਿਕ ਜਾਣਕਾਰੀ ਪ੍ਰਾਪਤ ਹੋ ਸਕੇ